ਭੰਗੜਾ ਇੱਕ ਬਹੁਤ ਹੀ ਵਧੀਆ ਡਾਂਸ ਵਿੱਚੋਂ ਹੁੰਦਾ ਹੈ ਜਿਸ ਦੇ ਰਾਹੀਂ ਕਿ ਤੁਸੀਂ ਆਪਣੇ ਪੂਰੇ ਸਰੀਰ ਦੀ ਕਸਰਤ ਕਰ ਸਕਦੇ ਹੋ ਅਤੇ ਇਸ ਨਾਲ ਤੁਹਾਡਾ ਸਰੀਰ ਬਹੁਤ ਹੀ ਤੰਦਰੁਸਤ ਅਤੇ ਵਧੀਆ ਬਣਦਾ ਹੈ ਜਿਸ ਨਾਲ ਕਿ ਤੁਹਾਡਾ ਲੱਤਾਂ ਵਿੱਚ ਜਾਨ ਪੈਦਾ ਹੁੰਦੀ ਹੈ ਅਤੇ ਇਸ ਨਾਲ ਤੁਹਾਡਾ ਸਰੀਰ ਦਾ ਤਾਲਮੇਲ ਬਣਦਾ ਹੈ ਅਤੇ ਤੁਸੀਂ ਬਹੁਤ ਹੀ ਕੋਡੀਨੇਟ ਕਰਦੇ ਹੋ ਸਰੀਰ ਨੂੰ ਭੰਗੜਾ ਸਿਰਫ਼ ਪੰਜਹ ਪੰਜਾਬ ਵਿੱਚ ਹੀ ਪ੍ਰਚਲਿਤ ਨਹੀਂ ਹੈ ਇਹ ਬਾਕੀ ਜਗ੍ਹਾਵਾਂ ਵੀ ਬਹੁਤ ਪ੍ਰਚਲਿਤ ਹੈ ਜਿਨ੍ਹਾਂ ਜਿੱਦਾਂ ਕਿ ਇੰਡੀਆ ਦੇ ਵਿੱਚ ਕੁਝ ਹਿੱਸੇ ਜਿਵੇਂ ਕਿ ਹਰਿਆਣਾ ਦੇ ਰਾਜਸਥਾਨ ਦੇ ਅਤੇ ਕਨੇਡਾ ਦੇ ਵਿੱਚ ਵੀ ਜਿਹੜੇ ਪੰਜਾਬੀ ਰਹਿੰਦੇ ਹਨ ਜਾਂ ਬਥੇਰੇ ਇਲਾਕਿਆਂ ਵਿੱਚ ਜਿੱਥੇ ਜਿੱਥੇ ਪੰਜਾਬੀ ਰਹਿੰਦੇ ਹਨ ਅਤੇ ਉਹਨਾਂ ਦੇ ਭਾਈ ਹੁਣੀ ਰਹਿੰਦੇ ਹਨ ਉਹਨਾਂ ਜਗ੍ਹਾਵਾਂ ਉੱਤੇ ਵੀ ਭੰਗੜਾ ਬਹੁਤ ਹੀ ਮਸ਼ਹੂਰ ਹੈ ਅਤੇ ਭੰਗੜਾ ਨੂੰ ਸਾਰੀ ਜਗ੍ਹਾਵਾਂ 'ਤੇ ਇੱਕ ਵਧੀਆ ਨਾਚ ਦੇ ਵਿੱਚ ਦੇਖਿਆ ਜਾਂਦਾ ਹੈ ਅਤੇ